ਪੰਜਾਬ ਵਿੱਚ ਮੁੱਖ ਟੈਕਨੋਲੋਜੀ ਕੈਰੀਅਰ ਦੇ ਮੌਕੇ ਜਾਂ ਸੰਭਾਵਨਾਵਾਂ ਕੀ ਹਨ ਸੰਕੇਤ ਨੌਕਰੀ ਦੇ ਬਾਜ਼ਾਰ ਤਨਖਾਹ ਹੁਨਰ ਮੰਗ ਪੰਜਾਬ ਦੇ ਮੁੱਖ ਟੈਕਨੋਲੋਜੀ ਕੈਰੀਅਰ ਦੇ ਮੌਕੇ ਜਾਂ ਸੰਭਾਵਨਾ ਹਨ ਬਾਜ਼ਾਰ ਬਹੁਤ ਲੋਕ ਅੱਜ ਦੇ ਜ਼ਮਾਨੇ ਦੇ ਵਿੱਚ ਬਾਜ਼ਾਰ ਦੇ ਵਿੱਚ ਪੈਸਾ ਲਗਾ ਕੇ ਉਸ 'ਤੇ ਆਪਣੀ ਚੀਜ਼ਾਂ ਆਪਣੇ ਫਨਾਂਸਿਸ ਨੂੰ ਮੈਨੇਜ ਕਰ ਰਹੇ ਹਨ ਬਹੁਤ ਲੋਕ ਆਪਣੇ ਤਨਖਾਹ ਬੇਸਿਕ ਨੌਕਰੀ ਤੋਂ ਵੀ ਬਾਜ਼ਾਰ ਦੇ ਵਿੱਚ ਪੈਸਾ ਲਗਾ ਕੇ ਆਪਣਾ ਵਾਧਾ ਕਰ ਰਹੇ ਹਨ ਇਸ ਦੇ ਵਿੱਚ ਹੁਨਰ ਦੀ ਵੀ ਬਹੁਤ ਲੋੜ ਹੈ ਅਤੇ ਇਸ ਨੂੰ ਸਿੱਖਣਾ ਵੀ ਬਹੁਤ ਜ਼ਰੂਰੀ ਹੈ ਇਹ ਚੀਜ਼ਾਂ ਸਭ ਹੁਨਰ ਬਾਜ਼ਾਰ ਅਤੇ ਇਸ ਦੀ ਮੰਗ ਟੈਕਨੋਲੋਜੀ ਦੁਆਰਾ ਹੀ ਸੰਭਵ ਹੋ ਸਕੀ ਹੈ ਤੈਕਨੋਲਜੀ ਕੈਰੀਅਰ ਤੋਂ ਬਿਨਾਂ ਇਹ ਸੰਭਵ ਨਹੀਂ ਸੀ